ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਪਠਾਨਕੋਟ ਤੋਂ ਬੋਲਦੀ ਪਈ ਹਾਂ ਪੰਜਾਬੀ ਭਾਸ਼ਾ ਬਾਰੇ ਦੱਸਿਆ ਜਾਵੇ ਤਾਂ ਸਾਡੇ ਪੰਜਾਬ ਵਿੱਚ ਪੰਜਾਬੀ ਜ਼ਿਆਦਾ ਪਸੰਦ ਹੈ ਔਰ ਵੀ ਕਈ ਭਾਸ਼ਾਵਾਂ ਹੋਵੇ ਭਾਸ਼ਾ ਬੋਲੀਆਂ ਜਾਂਦੀਆਂ ਜੀ ਅਤੇ ਬੱਚੇ ਅੱਜ ਕੱਲ੍ਹ ਜ਼ਿਆਦਾ ਹਿੰਦੀ ਬੋਲ ਰਹੇ ਨੇ ਸਕੂਲਾਂ ਵਿੱਚ ਵੀ ਹਿੰਦੀ ਬੋਲ ਰਹੇ ਨੇ ਘਰ ਵਿੱਚ ਵੀ ਹਿੰਦੀ ਸਿੱਖ ਰਹੇ ਨੇ ਤਾਂ ਕਿ ਸਾਨੂੰ ਸਭ ਤੋਂ ਜ਼ਿਆਦਾ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਇੰਗਲਿਸ਼ ਵੀ ਬੋਲ ਰਹੇ ਨੇ ਸਾਰੀਆਂ ਭਾਸ਼ਾਵਾਂ ਅੱਜ ਕੱਲ੍ਹ ਸੰਸਕ੍ਰਿਤ ਕੀਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਹੀ ਸਿਖਾਉਣੀ ਚਾਹੀਦੀ ਹੈ ਹੈ ਨਾ ਸਕੂਲ ਵਿੱਚ ਹਿੰਦੀ ਚੱਲ ਰਹੀ ਹੈ ਅਤੇ ਔਰ ਵੀ ਭਾਸ਼ਾਵਾਂ ਜਿਸ ਤਰ੍ਹਾਂ ਇੰਗਲਿਸ਼ ਹਿੰਦੀ ਬੱਚੇ ਸਭ ਕੁਛ ਸਿੱਖਣਾ ਚਾਹੁੰਦੇ ਆ ਪਰ ਸਾਨੂੰ ਸਭ ਤੋਂ ਜ਼ਿਆਦਾ ਪੰਜਾਬੀ ਹੀ ਸਿਖਾਉਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਹੀ ਸਿਖਾਉਣੀ ਚਾਹੀਦੀ ਆ ਬਸ ਮੇਰਾ ਇਹ ਕਹਿਣਾ ਕਿ ਆਪਣੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪੰਜਾਬੀ ਹੀ ਸਿਖਾਓ ਨਾ ਪ੍ਰਭਾਵਿਤ ਕੀਤਾ ਜਾਂਦਾ ਹੈ ਅੱਜ ਕੱਲ੍ਹ ਤਾਂ ਸਾਡੇ ਪੰਜਾਬ ਵਿੱਚ ਮਿਕਸ ਬੋਲੀ ਹੋ ਗਈ ਵੀ ਹੈ ਜਿਸ ਤਰ੍ਹਾਂ ਇੰਗਲਿਸ਼ ਬੋਲੀ ਜਾਂਦੇ ਪਏ ਬੱਚੇ ਪੰਜਾਬੀ ਬੋਲੀ ਜਾਂਦੇ ਪਏ ਨੇ ਔਰ ਵੀ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਪਰ ਸਾਨੂੰ ਸਭ ਤੋਂ ਜ਼ਿਆਦਾ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਪੰਜਾਬੀ ਹੀ ਸਿਖਾਉਣੀ ਚਾਹੀਦੀ ਹੈ ਸੰਸਕ੍ਰਿਤ ਘੱਟ ਤੋਂ ਘੱਟ ਜ਼ਿਆਦਾ ਪੰਜਾਬੀ ਤੋਂ ਪੰਜਾਬੀ ਹੀ ਸਿਖਾਉਣੀ ਚਾਹੀਦੀ ਹੈ ਥੈਂਕ ਯੂ ਸਰ